ਭਾਰਤ ਵਿੱਚ ਖਾਣ ਪੀਣ ਦੇ ਲੋਕ ਕਾਫ਼ੀ ਸ਼ੌਕੀਨ ਹਨ ਅਤੇ ਇਹ ਖੁੱਲ੍ਹਾ ਖਾਂਦੇ ਪੀਂਦੇ ਹਨ ਇਹਨਾਂ ਇਹ ਖੁੱਲ੍ਹਾ ਖਾਣ ਪੀਣ ਦੇ ਸ਼ੌਕੀਨ ਹਨ ਅਤੇ ਇਹ ਸਾਰਾ ਹੀ ਭੋਜਨ ਇਹ ਆਪਣੇ ਘਰਾਂ ਵਿੱਚ ਹੀ ਤਿਆਰ ਕਰਦੇ ਹਨ ਇਹਨਾਂ ਨੇ ਕਦੇ ਬਾਜ਼ਾਰ ਦਾ ਜਾਂ ਬਾਹਰ ਦੇ ਦੇਸ਼ ਦਾ ਕੋਈ ਉਹੋ ਜਿਹਾ ਖਾਣਾ ਨਹੀਂ ਖਾਂਦੇ ਇਹ ਘਰਾਂ ਵਿੱਚ ਹੀ ਤਿਆਰ ਕਰਕੇ ਭੋਜਨ ਖਾਂਦੇ ਹਨ ਜਿਸ ਵਿੱਚ ਦਾਲਾਂ ਸਬਜ਼ੀਆਂ ਦਾਲਾਂ ਸਬਜ਼ੀਆਂ ਅਤੇ ਹੋਰ ਵੀ ਪਕਵਾਨ ਜਿਹੜੇ ਤਿਆਰ ਕੀਤੇ ਜਾਂਦੇ ਹਨ ਜਿਸ ਤਰ੍ਹਾਂ ਅਸੀਂ ਦਹੀਂ ਲੱਸੀ ਦੁੱਧ ਦੁੱਧ ਤੋਂ ਤਿਆਰ ਹੋਣ ਵਾਲੀਆਂ ਵਸਤੂਆਂ ਵੀ ਅਸੀਂ ਖਾਂਦੇ ਹਾਂ ਅਤੇ ਨਾਲ ਇਹ ਆਪਣਾ ਇਹ ਮਸਾਲੇ ਜਿਹੜੇ ਅਸੀਂ ਬਾਜ਼ਾਰ ਤੋਂ ਲਿਆ ਕੇ ਆਪਣੇ ਖੁਦ ਘਰ ਤਿਆਰ ਕਰਕੇ ਅਤੇ ਫਿਰ ਅਸੀਂ ਉਹ ਮਸਾਲੇ ਵਰਤਦੇ ਹਾਂ ਅਤੇ ਉਹ ਮਸਾਲੇ ਸਾਡੇ ਸਿਹਤ ਵਾਸਤੇ ਅਤੇ ਹੋਰਾਂ ਚੀਜ਼ਾਂ ਵਾਸਤੇ ਬਹੁਤ ਚੰਗੇ ਹਨ ਅਤੇ ਸਾਡੀ ਸਿਹਤ ਵਧੀਆ ਜਿਸ ਨਾਲ ਸਾਡੀ ਸਿਹਤ ਵਧੀਆ ਰਹਿੰਦੀ ਹੈ ਘਰ ਦਾ ਖਾਣ ਪੀਣ ਦੇ ਨਾਲ